ਹਾਂ ਹੈਲੋ ਸਵੀਗੀ ਤੋਂ ਬੋਲ ਰਹੇ ਹੋ ਹਾਂ ਮੈਂ ਗੁਰਨਾਮ ਬੋਲਦਾ ਅਜ਼ਾਦ ਨਗਰ ਅੰਮ੍ਰਿਤਸਰ ਤੋਂ ਮੈਂ ਆਡਰ ਤੁਹਾਨੂੰ ਦਿੱਤਾ ਸੀ ਪੰਜ ਸੌ ਤਿਹੱਤਰ ਉਹ ਦਾਲ ਸਬਜ਼ੀ ਰੋਟੀ ਵਗੈਰਾ ਦਾ ਹਾਂ ਹਾਂ ਅਤੇ ਉਹ ਤੁਸੀਂ ਉਹਦੇ ਨਾਲ ਮਿਠਾਈ ਜਿਹੜੀ ਹੈ ਨਾ ਭੁੱਲ ਗਿਆਂ ਇੱਦਾਂ ਕਰਿਓ ਤਿੰਨ ਪਲੇਟਾਂ ਚਮ ਚਮ ਦੀਆਂ ਭੇਜ ਦਿਉ ਅਤੇ ਅਤੇ ਮਤਲਬ ਆਡਰ ਦੇ ਨਾਲ ਹੀ ਅਤੇ ਜਦੋਂ ਭੇਜੋਗੇ ਤੁਹਾਨੂੰ ਨਾਲ ਹੀ ਮਤਲਬ ਪੈਸੇ ਮਿਲ ਜਾਣਗੇ ਬਹੁਤ ਧੰਨਵਾਦ